ਹੈਲੋ ਕੀ ਤੁਸੀਂ ਬਾਬੇ ਕੇ ਢਾਬੇ ਤੋਂ ਬੋਲ ਰਹੇ ਜੀ ਹਾਂਜੀ ਮੈਂ ਕੁਝ ਔਡਰ ਕਰਨਾ ਸੀਗਾ ਹਾਂਜੀ ਕਿਆ ਕੜੀ ਚਾਵਲ ਹੈਗੇ ਤੁਹਾਡੇ ਕੋਲ ਹਾਂਜੀ ਪੂੜੀ ਛੋਲੇ ਮਟਰ ਪਨੀਰ ਦਸ ਚੁਪਾਟੀਆ ਅਤੇ ਇਹ ਸਾਰੇ ਪੈਕ ਕਰਕੇ ਤੁਸੀਂ ਰਾਜਾ ਦੀ ਹੱਟੀ ਨੀਅਰ ਦਾਣਾ ਮੰਡੀ ਉੱਥੇ ਪਹੁੰਚਾ ਦਿਓ ਕੋਸ਼ਿਸ਼ ਕਰਿਓ ਕਿ ਅੱਧੇ ਘੰਟੇ ਦੇ ਵਿੱਚ ਤੀਹ ਪੈਂਤੀ ਮਿੰਟ ਦੇ ਵਿੱਚ ਵਿੱਚ ਪਹੁੰਚ ਜਾਵੇ ਕਿਉਂਕਿ ਮੇਰੇ ਕੋਲ ਕੋਈ ਗੈਸਟ ਆਏ ਹੋਏ ਆ ਅਤੇ ਮੈਨੂੰ ਟਾਈਮ ਨਾਲ ਪਹੁੰਚਾ ਦੂੰਗੇ ਤਾਂ ਵਧੀਆ ਗੱਲ ਆ ਹਾਂਜੀ ਅਗਰ ਤੁਸੀਂ ਲੇਟ ਹੋਊਂਗੇ ਤਾਂ ਮੈਨੂੰ ਲੱਗਦਾ ਕਿ ਟਾਈਮ ਨਾਲ ਪਹੁੰਚਾ ਹੀ ਦੋਂਗੇ ਇਸ ਲਈ ਮੈਂ ਚਾਹੁੰਦਾ ਹਾਂ ਕਿ ਟਾਈਮ ਨਾਲ ਪਹੁੰਚਾ ਦਿਓ ਅਤੇ ਮੇਰੇ ਕੋਈ ਗੈਸਟ ਆ ਰਹੇ ਨੇ ਇਸ ਕਰਕੇ ਅਗਰ ਹੋਰ ਕੋਈ ਐਟਮ ਹਾ ਤਾਂ ਉਹਦੇ ਵਿੱਚ ਸ਼ਾਹੀ ਪਨੀਰ ਹੈ ਅਤੇ ਸ਼ਾਹੀ ਪਨੀਰ ਪਾ ਦਿਓ ਨਾਲ ਇੱਕ ਪਲੇਟ ਸ਼ਾਹੀ ਪਨੀਰ ਅਤੇ ਜਿਹੜਾ ਬਿੱਲ ਏ ਆ ਉਹ ਮੈਂ ਕੈਸ਼ ਹੀ ਪੇ ਕਰੂੰਗਾ ਜਦੋਂ ਵੀ ਉਹ ਆਏ ਉਹਨਾਂ ਨੂੰ ਮੈਂ ਕੈਸ਼ ਪੇਮੈਂਟ ਕਰ ਦੂੰਗਾ

ਤੀਹ ਮਿੰਟ ਤੀਹ ਪੈਂਤੀ ਮਿੰਟ ਦੇ ਵਿੱਚ ਵਿੱਚ ਮੇਰੇ ਕੋਲ ਔਡਰ ਪਹੁੰਚ ਜਾਣਾ ਚਾਹੀਦਾ ਆ ਠੀਕ ਹੈ ਜੀ ਓਕੇ